ਹੈਲੋ ਹੈਲੋ ਹਾਂਜੀ ਸਮਰਾ ਸਾਹਿਬ ਕੀ ਹਾਲ ਚਾਲ ਨੇ ਪਛਾ ਪਛਾਣ ਲਿਆ ਰਣੀਆਂ ਤੋਂ ਹਾਂਜੀ ਹਾਂਜੀ ਹਾਂਜੀ ਰਣੀਆਂ ਵਾਲਾ ਗੁਰਦੀਪ ਬੋਲਦਾ ਮੈਂ ਹੋਰ ਠੀਕ ਠਾਕ ਘਰ ਸਾਰੇ ਹੋਰ ਨਿਆਣੇ ਕਿਵੇਂ ਨੇ ਬੱਚੇ ਠੀਕ ਆ ਠੀਕ ਆ ਹੋਰ ਤੁਹਾਡੀ ਮਾਤਾ ਦਾ ਕੀ ਹਾਲ ਚਾਲ ਆ ਮੈਂ ਤਾਂ ਫੋਨ ਲਾਇਆ ਸੀਗਾ ਮੈਂ ਕਿਹਾ ਵੀ ਹੁਣ ਮਾਰਚ ਦਾ ਮਹੀਨਾ ਆਉਂਦਾ ਤਾਂ ਬਈ ਬੱਚਿਆਂ ਨੂੰ ਮਖਾਂ ਐਡਮਿਸ਼ਨ ਦਿਵਾਉਣੀ ਸੀ ਸਕੂਲ ਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਕੋਈ ਲੱਭਿਆ ਸਕੂਲ ਕੋਈ ਵਧੀਆ ਹਾਂਜੀ ਅੱਛਾ ਸਾਡੇ ਨਾ ਇੱਥੇ ਇੱਕ ਨੇੜੇ ਸਕੂਲ ਹੈਗਾ ਵਾ ਰਣਜੀਤ ਐਵਨਿਊ ਦੇ ਵਿੱਚ ਮਲੇਨੀਅਮ ਸਕੂਲ ਆ ਸੀ ਬੀ ਐਸ ਈ ਬੋਰਡ ਹਾਂਜੀ ਹਾਂਜੀ ਉੱਥੇ ਫੀਸ ਵੀ ਠੀਕ ਆ ਅਤੇ ਸਟਾਫ ਵੀ ਵਧੀਆ ਸਿਕਿਉਰਟੀ ਵਧੀਆ ਜੀ ਗੇਟ 'ਤੇ ਦੋ ਸਿਕਿਉਰਟੀ ਗਾਰਡ ਰੱਖੇ ਆ ਉਹਨਾਂ ਦੇ ਅਤੇ ਬੱਸਾਂ ਵੀ ਬਹੁਤ ਵਧੀਆ ਨੇ ਹਾਂ ਜੀ ਹਾਂ ਜੀ ਹਾਂ ਜੀ ਨਾਲੇ ਨੇੜੇ ਆ ਕੋਈ ਦੁੱਖ ਤਕਲੀਫ਼ ਹੁੰਦੀ ਆ ਬੰਦਾ ਚਲੇ ਵੀ ਜਾਂਦਾ ਅਤੇ ਤੁਹਾਡੇ ਏਰੀਏ ਦੇ ਵਿੱਚ ਵੀ ਬੱਸਾਂ ਜਾਂਦੀਆਂ ਉਹਨਾਂ ਦੀਆਂ ਅੱਛਾ ਅੱਛਾ ਹਾਂਜੀ ਹਾਂਜੀ ਤਾਂ ਹੀ ਮੈਂ ਤੁਹਾਨੂੰ ਫੋਨ ਲਾਇਆ ਸੀਗਾ ਮਹਾਂ ਚਲੋ ਆਪਾਂ ਦੋਨੇ ਜਾਣੇ ਜਾ ਕੇ ਤਾਂ ਗੱਲਬਾਤ ਕਰ ਆਈਏ ਉਹਨਾਂ ਨਾਲ ਫੀਸ ਕਿੰਨੀ ਆ ਹਾਂ ਹਾਂ ਤੁਸੀਂ ਪ੍ਰਿੰਸੀਪਲ ਨੂੰ ਜਾਣਦੇ ਹੋ ਉੱਥੇ ਕੌਣ ਨੇ ਅੱਛਾ ਅੱਛਾ ਜੀ ਹਾਂਜੀ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਕਹਿੰਦੇ ਸਕੂਲ ਵਧੀਆ ਵਾ ਹਾਂਜੀ ਹਾਂਜੀ ਹੋਰ ਤੁਸੀਂ ਹਾਂਜੀ ਹਾਂਜੀ ਤੁਸੀਂ ਦੇਖਿਆ ਕੋਈ ਇੱਧਰ ਆਪਣੇ ਅੱਛਾ ਜੀ ਅੱਛਾ ਜੀ ਇਹ ਸੀ ਬੀ ਐਸ ਈ ਬੋਰਡ ਆ ਅੱਛਾ ਜੀ ਫੀਸ ਕਿੱਦਾਂ ਚਾਹੇ ਕੀ ਹਿਸਾਬ ਕਿਤਾਬ ਆ ਜੀ ਠੀਕ ਪਹਿਲਾਂ ਕੋਈ ਬੱਚਾ ਪੜ੍ਹਦਾ ਤੁਹਾਡਾ ਇੱਧਰ ਕੋਈ ਅੱਛਾ ਜੀ ਚਲੋ ਫਿਰ ਤਾਂ ਤੁਹਾਨੂੰ ਭੇਤ ਹੀ ਹੋਣਾ ਇੱਧਰ ਤਾਂ ਚਲੋ ਆਪਾਂ ਫਿਰ ਇੱਦਾਂ ਕਰਾਂਗੇ ਦੋਨੋਂ ਸਕੂਲ ਦੇ ਵਿੱਚ ਵਿਜਿਟ ਕਰ ਲਵਾਂਗੇ ਜਿਹੜਾ ਹਾਂ ਜਿਹੜਾ ਵਧੀਆ ਲੱਗਿਆ ਆਪਾਂ ਉੱਥੇ ਫਿਰ ਐਡਮਿਸ਼ਨ ਕਰਵਾ ਦਵਾਂਗੇ ਬੱਚਿਆਂ ਦੀ ਹਾਂਜੀ ਬੱਚਿਆਂ ਨੂੰ ਦੇਖਦੇ ਹਾਂ ਕਿਹੜਾ ਪਸੰਦ ਆਉਂਦਾ ਹਾਂਜੀ ਹਾਂਜੀ ਹੋਰ ਸਭ ਠੀਕ ਠਾਕ ਤੁਹਾਡਾ ਮੁੰਡਾ ਜਿਹੜਾ ਵੱਡਾ ਉਹ ਕਿਹੜੇ ਸਕੂਲ ਪੜ੍ਹਦਾ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਜੀ ਚਲੋ ਪਹਿਲਾਂ ਆਪਾਂ ਇੱਦਾਂ ਕਰਾਂਗੇ ਮਲੇਨੀਅਮ ਸਕੂਲ ਚਲਾਂਗੇ ਮੈਂ ਆਊਂ ਤੁਹਾਡੇ ਘਰ ਮੋਟਰਸਾਈਕਲ 'ਤੇ ਤੁਸੀਂ ਮੇਰੇ ਨਾਲ ਚੱਲਿਓ ਹਾਂਜੀ ਜਿਹੜੇ ਤੁਸੀਂ ਗੱਡੀ ਨਵੀਂ ਲਿਆਂਦੀ ਆ ਆਪਾਂ ਉਹਦੇ ਵਿੱਚ ਚੱਲਾਂਗੇ ਅਤੇ ਸਤਿੰਦਰ ਸਰ ਦੀ ਸਿਫਾਰਿਸ਼ ਚੱਲਦੀ ਹੈ ਨਨਕਾਣਾ ਸਾਹਿਬ ਸਕੂਲ ਦੇ ਵਿੱਚ ਮੈਂ ਸੁਣਿਆ ਇੱਕ ਸਤਿੰਦਰ ਸਰ ਨੇ ਪੀ ਐਨ ਈ ਕਾਲਜ ਤੋਂ ਉਹਨਾਂ ਦਾ ਰੈਫਰੈਂਸ ਦੇ ਦਿਆਂਗੇ ਸ਼ਾਇਦ ਕੋਈ ਡਿਸਕਾਊਂਟ ਮਿਲ ਜਾਵੇ ਆਪਾਂ ਨੂੰ ਹੈ ਨਾ ਜੀ ਨਨਕਾਣਾ ਸਾਹਿਬ ਵਾਲੀ ਮੈਡਮ ਉਹਨਾਂ ਨੂੰ ਜਾਣਦੇ ਆ ਹਾਂਜੀ ਹਾਂਜੀ ਆਪਾਂ ਉਹਨਾਂ ਨਾਲ ਵੀ ਇੱਕ ਵਾਰ ਸੰਪਰਕ ਕਰ ਲਵਾਂਗੇ ਹਾਂਜੀ ਹਾਂਜੀ ਤਾਂ ਤੁਸੀਂ ਮੈਨੂੰ ਜ਼ਰੂਰ ਬਹੁ ਹਾਂਜੀ ਫੂਨ ਜ਼ਰੂਰ ਕਰਿਓ ਜਦੋਂ ਜਾਣਾ ਹੋਇਆ ਸੋਮਵਾਰ ਦਾ ਪੱਕਾ ਹੀ ਰੱਖਿਓ ਹਾਂਜੀ ਹਾਂਜੀ ਹੋਰ ਸਭ ਠੀਕ ਠਾਕ ਚਲੋ ਚੰਗਾ ਜੀ ਓਕੇ ਜੀ